ਪੰਜਾਬੀ ਭਾਸ਼ਾ ਸਾਡੀ ਪੰਜਾਬੀਆਂ ਦੀ ਮੇਨ ਭਾਸ਼ਾ ਹੈ ਜੋ ਕਿ ਸਾਡੀ ਪੰਜਾਬ ਬੋਲੀ ਹੈਗੀ ਹੈ ਇਹ ਵਪਾਰ ਵਿੱਚ ਵੀ ਵਣਜ ਵਿੱਚ ਵੀ ਪੰਜਾਬੀ ਮਾਂ ਬੋਲੀ ਵਰਤੀ ਹੀ ਜਾਂਦੀ ਹੈ ਜਿਹੜੇ ਆੜਤੀਏ ਆਰਤੀਏ ਹੁੰਦੇ ਹੈ ਜਾਂ ਕੋਈ ਹੋਰ ਪੁਰਾਣੇ ਗਹਿਣੇਦਾਰ ਕੋਈ ਵੀ ਲੋਕ ਹੈ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹੀ ਕਰਦੇ ਹੈ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹੈ ਪੰਜਾਬੀ ਭਾਸ਼ਾ ਜ਼ਰੂਰੀ ਵੀ ਹੈ ਹਰ ਗੱਲ ਪੰਜਾਬੀ ਵਿੱਚ ਹੀ ਕੀਤੀ ਜਾਂਦੀ ਹੈ ਵਪਾਰ ਵਿੱਚ ਵੀ ਮੰਡੀਆਂ ਵਿੱਚ ਵੀ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਹੋਰ ਪੰਜਾਬੀ ਭਾਸ਼ਾ 'ਚ ਫ਼ਸਲਾਂ ਦੇ ਬੀਜ ਵਗੈਰਾ ਵੀ ਦਿੱਤੇ ਜਾਂਦੇ ਆ ਪੰਜਾਬੀ ਪੰਜਾਬੀ ਭਾਸ਼ਾ 'ਚ ਏ ਬੋਲੇ ਜਾਂਦੇ ਆ ਪੰਜਾਬ ਵਿੱਚ ਪੰਜਾਬੀ ਭਾਸ਼ਾ ਬਹੁਤ ਹੀ ਜ਼ਰੂਰੀ ਹੈਗੀ ਹੈ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦੀ ਤਾਂ ਕੋਈ ਉਦਾਹਰਣ ਹੀ ਨਹੀਂ ਹੈਗੀ ਕੋਈ ਉਦਾਹਰਣ ਹੀ ਨਹੀਂ ਪੰਜਾਬੀ ਭਾਸ਼ਾ ਸਾਡੇ ਸਮਾਜ ਲਈ ਬਹੁਤ ਜ਼ਰੂਰੀ ਹੈ ਵਪਾਰ ਵਪਾਰ ਵੀ ਪੰਜਾਬੀ ਭਾਸ਼ਾ ਵਿੱਚ ਹੀ ਲੋਕ ਕਰਦੇ ਆ ਕੋਈ ਵੀ ਵਪਾਰੀ ਕੋਈ ਵੀ ਚੀਜ਼ ਖਰੀਦਣ ਆਉਂਦਾ ਹੈ ਕੁਛ ਵੀ ਆਉਂਦਾ ਹੈ ਪੰਜਾਬੀ ਲੈਂਗੁਏਜ 'ਚ ਹੀ ਪੰਜਾਬੀ ਭਾਸ਼ਾ ਵਿੱਚ ਹੀ ਉਹ ਬੋਲਦਾ ਹੈ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਇਸ ਤਰ੍ਹਾਂ ਚਾਹੀਦਾ ਵਾ ਕੋਈ ਵੀ ਚੀਜ਼ ਲੈਣੀ ਹੈ ਕੋਈ ਵੀ ਵਪਾਰ ਕਰਨਾ ਹੈ ਪੰਜਾਬੀ ਭਾਸ਼ਾ ਵਿੱਚ ਬੋਲਣਾ ਹੀ ਪੈਂਦਾ ਪੰਜਾਬੀ ਭਾਸ਼ਾ ਨਾਲ ਪੰਜਾਬ ਵਿੱਚ ਹੈਗੀ ਵੀ ਮੇਨ ਬੋਲੀ ਹੈ ਪੰਜਾਬ ਵਿੱਚ